ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਪਰਮਿੰਦਰ ਕੌਰ ਹੈ ਅਤੇ ਮੈਂ ਜ਼ਿਲ੍ਹਾ ਪਠਾਨਕੋਟ ਦੀ ਰਹਿਣ ਵਾਲੀ ਹਾਂ ਮੈਂ ਖਾਣੇ ਦਾ ਔਡਰ ਵਾਪਸ ਕਰਨ ਦਾ ਇਹ ਕਾਰਨ ਹੈ ਕਿ ਜਦੋਂ ਆਪਾਂ ਖਾਣਾ ਮੰਗਵਾਇਆ ਤਾਂ ਉਸ ਦੀ ਪੈਕੇਜਿੰਗ ਦਾ ਬਹੁਤ ਹੀ ਜ਼ਿਆਦਾ ਬੁਰਾ ਹਾਲ ਸੀ ਅਤੇ ਸਾਰਾ ਹੀ ਖਾਣੇ ਵਾਲਾ ਭੋਜਨ ਜਿਹੜਾ ਹੈਗਾ ਉਹ ਡੱਬੇ ਦੇ ਆਲੇ ਦੁਆਲੇ ਲੱਗਾ ਹੋਇਆ ਸੀ ਇਸ ਕਰਕੇ ਸਾਨੂੰ ਉਹ ਬਿਲਕੁਲ ਪਸੰਦ ਨਹੀਂ ਆਇਆ ਅਤੇ ਅਸੀਂ ਖਾਣਾ ਵਾਪਸ ਭਿਜਵਾਉਣ ਦੇ ਬਾਰੇ ਸੋਚਿਆ